ਹੈਲੋ ਹਾਂਜੀ ਹਰਦੀਪ ਟੈਲੀਕਮ ਤੋਂ ਬੋਲਦੇ ਜੀ ਨਵਾਂਸ਼ਹਿਰ ਤੋਂ ਹਾਂਜੀ ਭਾਅ ਜੀ ਮੈਂ ਨਾ ਤੁਹਾਡੇ ਤੋਂ ਫੋਨ ਲੈਣਾ ਸੀ ਦਸ ਹਜ਼ਾਰ ਦੇ ਵਿੱਚ ਵਿੱਚ ਹੋਵੇ ਰੇਂਜ ਫੋਨ ਦੀ ਕਿਹੜੇ ਕਿਹੜੇ ਕੰਪਨੀਆਂ ਦੇ ਆਪਣੇ ਕੋਲ ਫੋਨ ਹੈਗੇ ਆ ਅਤੇ ਇੱਕ ਭਾਅ ਜੀ ਮੈਨੂੰ ਦੱਸਿਓ ਰੀਅਲਮੀ ਜਿਹੜੀ ਕੰਪਨੀ ਹੈਗੀ ਆ ਉ ਉਹ ਦਸ ਹਜ਼ਾਰ ਦੇ ਮਤਲਬ ਜਿਹੜੇ ਹੈਗੇ ਆ ਰੇਂਜ ਦੇ ਵਿੱਚ ਆ ਜਾਂਦਾ ਕੋਈ ਫੋਨ ਵਧੀਆ ਮਤਲਬ ਹੋਵੇ ਹਾਂਜੀ ਹਾਂਜੀ ਇੱਕ ਚੀਜ਼ ਦੇਖਿਉ ਸਾਨੂੰ ਨਾ ਉਹਦੇ ਵਿੱਚ ਵੀਡੀਓ ਰਿਕੋਰਡਿੰਗ ਮਤਲਬ ਫੋਟੋ ਖਿੱਚਣ ਵਾਲਾ ਕੈਮਰੇ ਉਹ ਵਧੀਆ ਹੋਵੇ ਰੈਮ ਵੀ ਵਧੀਆ ਹੋਵੇ ਕਿਉਂਕਿ ਮੈਂ ਉ ਰਿਕੋਰਡਿੰਗ ਵਗੈਰਾ ਕਰਨੀ ਹੁੰਦੀ ਤਾਂ ਕਿ ਮੈਨੂੰ ਮੇਰਾ ਜਿਹੜਾ ਬਜਟ ਆ ਉਹ ਦਸ ਹਜ਼ਾਰ ਦੇ ਵਿੱਚ ਵਿਚ ਦਾ ਹੀ ਹੈ ਜੀ ਕਲਰ ਕਿਹੜਾ ਕਿਹੜਾ ਕਲਰ ਹੈਗਾ ਇਹਨਾਂ ਵਿੱਚ ਨਾਲੇ ਮੋਡਲ ਨੰਬਰ ਅੱਛਾ ਅਤੇ ਹੋਰ ਇੱਕ ਸੈਂਮਸੰਗ ਕੰਪਨੀ ਦਾ ਕੋਈ ਦਸ ਹਜ਼ਾਰ ਦੇ ਵਿੱਚ ਜਾਂ ਫਿਰ ਹਾਂਜੀ ਅੱਛਾ ਜੀ ਅਤੇ ਇਹਨਾਂ ਦੇ ਇਹ ਇਹਨਾਂ ਦੇ ਵਿੱਚ ਗਰੰਟੀ ਵਗੈਰਾ ਸਾਰਾ ਕੁਛ ਆਪਣੇ ਚਾਰਜਰ ਵਗੈਰਾ ਮਿਲ ਜਾਂਦੇ ਨਾਲ ਜੀ ਚਾਰ ਆਪਣੇ ਕਿਉਂਕਿ ਹੈਡਫੋਨ ਕਈ ਫੋਨਾਂ ਦੇ ਨਾਲ ਨਹੀਂ ਮਿਲਦੇ ਇਹਨਾਂ ਨਾਲ ਮਿਲ ਜਾਂਦੇ ਜੀ ਤੁਸੀਂ ਦੱਸਿਆ ਠੀ ਠੀਕ ਆ ਠੀਕ ਆ ਭਾਅ ਜੀ ਮੈਂ ਨਾ ਥੋੜ੍ਹਾ ਹੁਣ ਕਨਫਿਊਜ ਹੋ ਗਿਆ ਕਿਉਂਕਿ ਬਹੁਤ ਮੋਡਲ ਤੁਸੀਂ ਦੱਸੇ ਵੀ ਹੈਗੇ ਆ ਅਤੇ ਮੈਂ ਤੁਹਾਡੇ ਕੋਲ ਐਤਵਾਰ ਨੂੰ ਤੁਹਾਡੇ ਕੋਲ ਆ ਸਕਦਾ ਹਾਂ ਠੀਕ ਆ ਠੀਕ ਠੀਕ ਆ ਭਾਅ ਜੀ ਮੈਨੂੰ ਵੱਟਸਐਪ 'ਤੇ ਲੋਕੇਸ਼ਨ ਭੇਜ ਸਕਦੇ ਨਾ ਤੁਸੀਂ ਇਸ ਨੰਬਰ 'ਤੇ ਭੇਜ ਦਿਉ ਵੱਟਸਐਪ 'ਤੇ ਠੀਕ ਹੈ ਧੰਨਵਾਦ